ਮੈਨੂੰ ਅਜਿਹਾ ਲੱਗਦਾ ਹੈ ਕਿ ਮੇਰੇ ਵਿੱਚ ਕਈ ਹੁਨਰ ਹਨ ਜਿਵੇਂ ਪੇਂਟਿੰਗ ਕਰਨਾ ਪੌਦੇ ਉਗਾਣਾ ਸਭ ਤੋਂ ਜ਼ਿਆਦਾ ਮੇਰੇ ਵਿੱਚ ਕੱਪੜੇ ਸਿਊਣ ਦਾ ਹੁਨਰ ਹੈ ਮੈਂ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾਉਂਦੀ ਰਹਿੰਦੀ ਹਾਂ ਮੈਂ ਬੋਲੀਵੁੱਡ ਐਕਟਰਾਂ ਦੇ ਕੱਪੜਿਆਂ ਨੂੰ ਫੋਲੋ ਕਰਦੀ ਰਹਿੰਦੀ ਹਾਂ ਅਤੇ ਉਹਨਾਂ ਵਰਗੇ ਹੀ ਡਿਜ਼ਾਇਨ ਬਣਾਉਂਦੀ ਰਹਿੰਦੀ ਹਾਂ ਇਸ ਤੋਂ ਇਲਾਵਾ ਮੈਂ ਇੰਸਟਾਗ੍ਰਾਮ ਦੇ ਕਾਫੀ ਪੇਜ ਫੋਲੋ ਕੀਤੇ ਹੋਏ ਹਨ ਅਤੇ ਮੈਂ ਉਹਨਾਂ ਦੀ ਮਦਦ ਨਾਲ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾਉਂਦੀ ਹਾਂ ਯੂਟਿਊਬ ਤੋਂ ਵੀ ਮੈਂ ਵੱਖਰੀ ਵੱਖਰੀ ਵੀਡੀਓਸ ਦੇਖਦੀ ਰਹਿੰਦੀ ਹਾਂ ਜਿਨ੍ਹਾਂ ਨਾਲ ਮੈਨੂੰ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾਉਣ ਬਾਰੇ ਪਤਾ ਲੱਗਦਾ ਹੈ ਸਭ ਅਗਰ ਮੈਂ ਗੱਲ ਕਰਾਂ ਕਿ ਮੈਂ ਇਹ ਹੁਨਰ ਕਿਵੇਂ ਵਿਕਸਿਤ ਕੀਤਾ ਤਾਂ ਇਸ ਵਿੱਚ ਮੇਰੀ ਮਾਤਾ ਜੀ ਨੇ ਮੈਨੂੰ ਸਭ ਤੋਂ ਵੱਧ ਸਹਿਯੋਗ ਦਿੱਤਾ ਉਹਨਾਂ ਨੇ ਮੈਨੂੰ ਘਰ ਵਿੱਚ ਨੌਰਮਲ ਕੱਪੜੇ ਬਣਾਉਣੇ ਸਿਖਾਏ ਉਸ ਤੋਂ ਬਾਅਦ ਮੈਂ ਇੱਕ ਸ ਸਿਲਾਈ ਕੇਂਦਰ ਵਿੱਚ ਜਾ ਕੇ ਕੱਪੜੇ ਸਿਉਣ ਦਾ ਕੰਮ ਕੀਤਾ ਇਸ ਨਾਲ ਮੈਂ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾਉਣੇ ਸਿੱਖੇ ਅਤੇ ਮੈਨੂੰ ਹੁਣ ਕਈ ਤਰ੍ਹਾਂ ਦੇ ਨਵੇਂ ਡਿਜ਼ਾਇਨਾਂ ਬਾਰੇ ਪਤਾ ਲੱਗ ਚੁੱਕਾ ਹੈ ਮੈਂ ਇਹਨਾਂ ਕੱਪੜਿਆਂ ਨੂੰ ਵੇਚਦੀ ਹਾਂ ਅਤੇ ਇਹ ਮੇਰਾ ਧਨ ਕਮਾਉਣ ਦਾ ਸਭ ਤੋਂ ਵਧੀਆ ਸਾਧਨ ਹੈ